ਹ ਹੈਲੋ ਹਾਂਜੀ ਆਸ਼ੂ ਜੀ ਗੱਲ ਕਰਦੇ ਹੋ ਹਾਂਜੀ ਮੈਂ ਅਰਪਿਤ ਗੱਲ ਕਰਦਾ ਸੀਗਾ ਹਾਂਜੀ ਮੈਂ ਇੱਕ ਮਕਾਨ ਲੱਭ ਰਿਹਾ ਸੀਗਾ ਅਤੇ ਕਿਸੇ ਨੇ ਤੁਹਾਡੇ ਬਾਰੇ ਦੱਸਿਆ ਸੀਗਾ ਹਾਂਜੀ ਕੋਈ ਹੈਗਾ ਤੁਹਾਡੇ ਧਿਆਨ 'ਚ ਮਕਾਨ ਕੋਈ ਕਿਰਾਏ 'ਤੇ ਚਾਹੀਦਾ ਸੀ ਆਪਾਂ ਨੂੰ

ਬਸ ਵੀਹ ਸੱਠ ਦਾ ਹੋਜੇ ਬਹੁਤ ਹੈ ਰੈਂਟ ਕੋਈ ਛੇ ਤੋਂ ਦਸ ਹਜ਼ਾਰ ਦੇ ਵਿੱਚ ਵਿੱਚ ਹੋੋਜੇ ਤਾਂ ਠੀਕ ਹੈ ਹਾਂਜੀ ਟੂ ਬੀ ਐਚ ਕੇ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਹਾਂਜੀ ਥੋੜ੍ਹਾ ਜਿਹਾ ਸ਼ਾਂਤ ਜਿਹਾ ਜਿੱਦਾਂ ਸਿਵਲ ਲਾਈਨਸ ਸਾਈਡ 'ਤੇ ਹੋਜੇ ਇੱਕ ਤਾਂ ਬਹੁਤ ਅੱਛੀ ਗੱਲ ਹੈ

ਨਹੀਂ ਜੀ ਸੈਪਰੇਟ ਸਾਨੂੰ ਚਾਹੀਦਾ ਸੀਗਾ ਜਿੱਥੇ ਹੋਰ ਨਾ ਕੋਈ ਵਿੱਚ ਹੋਵੇ ਬਸ ਛੇ ਤੋਂ ਦਸ ਹਜ਼ਾਰ ਦੇ ਵਿੱਚ ਵਿੱਚ ਹੋੋਜੇ ਤਾਂ ਬਹੁਤ ਵਧੀਆ ਗੱਲ ਹੈ ਬਾਕੀ ਥੋੜ੍ਹਾ ਬਹੁਤ ਐਡਜਸਟ ਕਰ ਲਵਾਂਗੇ ਹਾਂਜੀ ਹਾਂਜੀ ਪਰ ਥੋੜ੍ਹਾ ਬਹੁਤ ਕਰ ਲਵਾਂਗੇ ਐਡਜਸਮੈਂਟ ਫਿਰ ਹਾਂਜੀ ਫਰਨੀਚਰ ਸਾਡਾ ਆਪਦਾ ਹੋਏਗਾ ਹਾਂਜੀ ਹਾਂਜੀ ਉਹ ਠੀਕ ਹੈ ਜੀ ਕੋਈ ਗੱਲ ਨਹੀਂ ਹਾਂਜੀ ਠੀਕ ਹੈ ਜੀ ਠੀਕ ਓਕੇ